ਹੈਲੋ ਆਰਤੀ ਹੋਰ ਕੀ ਕਰਦੀ ਪਈ ਆਰਤੀ ਅੱਜ ਕੱਲ੍ਹ ਫ੍ਰੀ ਪੇਪਰ ਦੇਣ ਤੋਂ ਬਾਅਦ ਬਸ ਕੁਛ ਨਹੀਂ ਪੇਪਰ ਦੇ ਲਏ ਆ ਹੁਣ ਫ੍ਰੀ ਅਤੇ ਸੋਚਦੇ ਪਏ ਕਿ ਅੱਗੇ ਹੁਣ ਕਿੱਥੇ ਜਾਣਾ ਕੀ ਕਰੀਏ ਅਤੇ ਚਲੋ ਮੈਂ ਚੱਲ ਆਰਤੀ ਨੂੰ ਪੁੱਛਦੀ ਹਾਂ ਕਿ ਆਪਣੇ ਗੁਰਦਾਸਪੁਰ ਦੇ ਵਿੱਚ ਕਿਹੜੇ ਕਿਹੜੇ ਕੌਲਜ ਹੈਗੇ ਜਿਹੜੇ ਵਧੀਆ ਆ ਜਿਵੇਂ ਸੋਚਿਆ ਕੁਛ ਹਾਂ ਬੇਅੰਤ ਕੌਲਜ ਬੇਅੰਤ ਅਤੇ ਜਾਂ ਹੈ ਸੁਖਜਿੰਦਰਾ ਵੀ ਹੈ ਅਤੇ ਹੋਰ ਕੀ ਕਰਨ ਦਾ ਸੋਚਿਆ ਅੱਗੇ ਹੁਣ ਮੈਨੂੰ ਤਾਂ ਘਰ ਹਾਂ ਬੀ ਐੱਸ ਸੀ ਕਹਿੰਦੇ ਪਏ ਕਰਨ ਵਾਸਤੇ ਅਤੇ ਪਰ ਸੋਚਿਆ ਕੁਛ ਕਿਹੜੇ ਕੌਲਜ ਐਡਮਿਸ਼ਨ ਲੈਣੀ ਆ ਅੱਛਾ ਮੈਨੂੰ ਤਾਂ ਸੁਖਜਿੰਦਰਾ ਕਹਿੰਦੇ ਪਏ ਲੈਣ ਵਾਸਤੇ ਇੱਕ ਸੁਖਜਿੰਦਰਾ 'ਚ ਲੈ ਲੈਂਦੇ ਹਾਂ ਕਿ ਬੀ ਐੱਸ ਸੀ ਉੱਥੇ ਕਰ ਲੈਂਦੇ ਮੈਂ ਕਿਹਾ ਚਲੋ ਆਰਤੀ ਨੂੰ ਪੁੱਛਦੇ ਹਾਂ ਕਿ ਇਕੱਠੇ ਲੈ ਲਵਾਂਗੇ ਜਿੱਥੇ ਕਰਨੀ ਆ ਫਿਰ ਸੁਖਜਿੰਦਰਾ ਹਾਂ ਬੱਸ ਫੈਸਿਲਿਟੀ ਹੈਗੀ ਸੁਖਜਿੰਦਰਾ ਦੀ ਆਉਣਾ ਜਾਣਾ ਈਜ਼ੀ ਹੋ ਜਾਵੇਗਾ ਸਟਾਫ਼ ਮੇਰੀ ਹਾਂ ਮੇਰੀ ਕਜ਼ਨ ਪੜ੍ਹਦੀ ਸੀ ਉੱਥੇ ਅਤੇ ਕਹਿੰਦੀ ਏ ਕਿ ਵਧੀਆ ਸਟੱਡੀ ਹੈਗੀ ਉੱਥੇ ਵਧੀਆ ਮਤਲਬ ਕਿ ਠੀਕ ਹੈ ਵਧੀਆ ਅਤੇ ਚਲੋ ਮੈਂ ਕਹਿੰਦੇ ਬਾਕੀ ਤੂੰ ਵੀ ਸਲਾਹ ਕਰ ਲਾ ਘਰ ਪੁੱਛ ਲੈ ਕੀ ਕਹਿੰਦੇ ਘਰਦੇ ਚੱਲ ਇਹ ਆ ਕਿ ਇਕੱਠੇ ਐਡਮਿਸ਼ਨ ਲੈ ਲਵਾਂਗੇ ਤਾਂ ਵਧੀਆ ਹੋ ਜਾਵੇਗਾ ਹੈ ਨਾ

ਬਾਕੀ ਤੂੰ ਹੀ ਦੇਖ ਲੈ ਜਿੱਥੇ ਲੈਣੀ ਏ ਜੇ ਤੂੰ ਹੋਰ ਕਿਤੇ ਲੈਣੀ ਤਾਂ ਮੈਂ ਉੱਥੇ ਲੈ ਲਵਾਂਗੀ ਹੈਨਾ ਕੌਲਜ ਤਾਂ ਵਧੀਆ ਹੈਗੇ ਆ ਇਹਦਾ ਇਹ ਕਿ ਮੇਰੀ ਕਜ਼ਨ ਇੱਥੇ ਪੜ੍ਹਦੀ ਸੀ ਉਹਨੇ ਦੱਸਿਆ ਸਾਰਾ ਕਿ ਵਧੀਆ ਫੈਸਿਲਿਟੀ ਹੈਗੀ ਏ ਸਟਾਫ਼ ਵੀ ਵਧੀਆ ਐਜੂਕੇਸ਼ਨ ਵੀ ਵਧੀਆ ਇੱਥੇ ਹਾਂ ਠੀਕ ਠੀਕ ਠੀਕ ਚੱਲ ਦੱਸੀਂ ਫੇਰ ਟਾਈਮ ਨਾਲ ਠੀਕ ਆ ਓ ਚੱਲ ਠੀਕ ਆ ਫਿਰ ਓਕੇ